ਮੈਂ ਸ਼ੀਤਲ ਕੁਮਾਰੀ ਮਿਰਜ਼ਾਪੁਰ ਪਿੰਡ ਦੀ ਰਹਿਣ ਵਾਲੀ ਹਾਂ ਜੋ ਕਿ ਪਠਾਨਕੋਟ ਜ਼ਿਲ੍ਹਾ ਜ਼ਿਲ੍ਹੇ ਵਿੱਚ ਪੈਂਦਾ ਹੈ ਮੈਂ ਦੱਸਣਾ ਚਾਹੁੰਦੀ ਹਾਂ ਮੈਂ ਅੱਗੇ ਵੀ ਆਨਲਾਈਨ ਕਈ ਤਰ੍ਹਾਂ ਦਾ ਸਮਾਨ ਮੰਗਵਾਉਂਦੀ ਹਾਂ ਪਰ ਪਿਛਲੇ ਹਫਤੇ ਜਦੋਂ ਮੈਂ ਇੱਕ ਕੁੜਤੇ ਦਾ ਆਡਰ ਦਿੱਤਾ ਤਾਂ ਉਹ ਕੁੜਤਾ ਜਦ ਮੇਰੇ ਤੱਕ ਪਹੁੰਚਿਆ ਜਦੋਂ ਮੈਂ ਉਸ ਨੂੰ ਪਾਲਸਲ ਵਿੱਚੋਂ ਕੱਢਿਆ ਤਾਂ ਉਹ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕਿਉਂਕਿ ਜੋ ਚੀਜ਼ ਦਾ ਮੈਂ ਆਰਡਰ ਦਿੱਤਾ ਸੀ ਉਹ ਚੀਜ਼ ਤਾਂ ਮੈਨੂੰ ਮਿਲੀ ਨਹੀਂ ਸੀ ਕਿਉਂਕਿ ਤੁਸੀਂ ਤਾਂ ਮੈਨੂੰ ਕੁਝ ਹੋਰ ਹੀ ਭੇਜ ਦਿੱਤਾ ਸੀ ਜੋ ਕਿ ਮੈਨੂੰ ਪਸੰਦ ਨਹੀਂ ਸੀ ਮੈਂ ਇਸ ਕਰਕੇ ਦੱਸਣਾ ਚਾਹੁੰਦੀ ਹਾਂ ਕਿ ਕਿਰਪਾ ਕਰਕੇ ਜੋ ਵੀ ਗਾਹਕ ਮੰਗਣ ਉਹ ਹੀ ਚੀਜ਼ ਨੂੰ ਭੇਜਿਆ ਜਾਵੇ ਤਾਂ ਕਿ ਗਾਹਕਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸ ਸਾਹਮਣਾ ਨਾ ਕਰਨਾ ਪਵੇ ਇੱਕ ਤਾਂ ਇਸ ਦਾ ਕਲਰ ਇਸ ਦਾ ਰੰਗ ਧੋਣ ਤੋਂ ਬਾਅਦ ਖਰਾਬ ਹੋ ਗਿਆ ਜੋ ਕਿ ਗਾਹਕ ਨੂੰ ਚੰਗਾ ਨਹੀਂ ਲੱਗਦਾ ਇਸ ਕਰਕੇ ਤੁਸੀਂ ਮੇਰੇ ਇਹ ਬੇਨਤੀ ਸਵੀਕਾਰ ਕਰੋ ਕਿ ਜੋ ਵੀ ਚੀਜ਼ ਦਾ ਕੋਈ ਔਡਰ ਕਰੇ ਉਸ ਹੀ ਚੀਜ਼ ਨੂੰ ਉਸ ਹੀ ਰੰਗ ਨੂੰ ਭੇਜਣਾ ਤੁਹਾਡਾ ਫਰਜ਼ ਹੈ ਮੈਂ ਇੱਕ ਵਾਰ ਫਿਰ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਮੇਰੇ ਮਨ ਪਸੰਦ ਦੀ ਚੀਜ਼ ਨਹੀਂ ਭੇਜੀ ਧੰਨਵਾਦ